ਜਿੱਦਾਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਅੰਮ੍ਰਿਤਸਰ ਖੇਤਰ ਵਿੱਚ ਬਹੁਤ ਸਾਰੇ ਕਾਰੋਬਾਰ ਸ਼ੁਰੂ ਕੀਤੇ ਜਾ ਸਕਦੇ ਜਿੱਦਾਂ ਕੱਪੜੇ ਦਾ ਹੋ ਗਿਆ ਮੋਬਾਇਲਾਂ ਦਾ ਹੋ ਗਿਆ ਜਾਂ ਇਲੈਟਰੀਕੇਸ਼ਨ ਦਾ ਹੋ ਗਿਆ ਕਿੱਦਾਂ ਆਪਣੇ ਮੰਨ ਲਉ ਕਿ ਫੂਡ ਫਾਸਟ ਫੂਡ ਹੋ ਗਿਆ ਹੋਟਲਸ ਹੋ ਗਏ ਅੰਮ੍ਰਿਤਸਰ 'ਚ ਜ਼ਿਆਦਾ ਤਾਂ ਹੋਟਲਸ ਅਤੇ ਫਾਸਟ ਫੂਡ ਹੋ ਗਿਆ ਕਿਤੇ ਕੱਪੜਿਆਂ ਦੇ ਹੋ ਗਏ ਪਰ ਮੈਨੂੰ ਜ਼ਿਆਦਾ ਮੋਬਾਇਲ 'ਚ ਇੰਟਰਸਟ ਹੈਗਾ ਅਤੇ ਮੈਂ ਮੋਬਾਇਲ ਦੀ ਇਲੈਟਰੀਕੇਸ਼ਨ ਦੀ ਪੜ੍ਹਾਈ ਵੀ ਕਰਨ ਡਿਆਂ ਵਾਂ ਅਗਾਂਹ ਮੈਂ ਅੱਗੇ ਆਈ ਟੀ ਆਈ ਵੀ ਕਰਨੀ ਹੈ ਆਈ ਟੀ ਆਈ 'ਚ ਪਰ ਮੈਂ ਯੂਟਿਊਬ ਦੇ ਉੱਤੇ ਵੀ ਦੇਖਦਾ ਰਹਿੰਦਾ ਕਿੱਦਾਂ ਮੋਬਾਈਲ ਦੀ ਸੈਟਿੰਗ ਕਰੀ ਦੀ ਆ ਜਾਂ ਕਿੱਦਾਂ ਆਪਾਂ ਨੂੰ ਗੈਜੀਟ ਹੁੰਦੇ ਆ ਕਿਹੜੇ ਉਹਨਾਂ ਦਾ ਕੀ ਕੀ ਪ੍ਰੋਗਰੈਸ ਹੁੰਦਾ ਵਾ ਜਿਹੜੇ ਕਿ ਅੱਜ ਗੈਜੀਟ ਨਾਲ ਮੈਨੂੰ ਬਹੁਤ ਪਿਆਰ ਆ ਅਤੇ ਨਾਲੇ ਬਹੁਤ ਹੀ ਆਪਾਂ ਨੂੰ ਵਧੀਆ ਲੱਗਦਾ ਵਾ ਮੈਂ ਖਰੀਦਦਾ ਵੀ ਹਾਂ ਅਤੇ ਅਗਾਂਹ ਮੈਂ ਵਿੱਚੋਂ ਵਿੱਚੋਂ ਸੇਲ ਵੀ ਕਰ ਲੈਂਦਾ ਵਾਂ ਗੈਜੀਟ ਅਤੇ ਆਪਣੇ ਕਿਹੜੇ ਹੁੰਦੇ ਆ ਲੋਕ ਉਹ ਤੁਹਾਨੂੰ ਪਤਾ ਬਾਹਰੋਂ ਬਾਹਰੋਂ ਆ ਕੇ ਕਿੱਦਾਂ ਆਪਣੇ ਇੱਥੇ ਅੰਮ੍ਰਿਤਸਰ 'ਚ ਬਹੁਤ ਸਾਰੇ ਸੈਲਾਨੀ ਆਉਂਦੇ ਆ ਸੈਲਾਨੀਆਂ ਦੇ ਕਿਹੜੇ ਗੈਜੀਟ ਹੁੰਦੇ ਕਈ ਵਾਰੀ ਖਰਾਬ ਹੋ ਜਾਂਦੇ ਜਾਂ ਕੋਈ ਉਹਨਾਂ ਦੇ ਦਿੱਕਤ ਹੁੰਦੀ ਆ ਆਪਾਂ ਉਹਨਾਂ ਨੂੰ ਠੀਕ ਕਰ ਸਕਦੇ ਹਾਂ ਅਤੇ ਮੈਨੂੰ ਮੌਕਾ ਵੀ ਮਿਲੇ ਤਾਂ ਮੈਂ ਮੋਬਾਈਲਾਂ ਦੀ ਦੁਕਾਨ ਖੋਲੂੰਗਾ ਉਹ ਵੀ ਅੰਮ੍ਰਿਤਸਰ ਵਿੱਚ ਅਤੇ ਕਵਰ ਹੋ ਗਏ ਕਿੱਦਾਂ ਲੀਡਸ ਹੋ ਗਈਆਂ ਏਅਰਪੋਡਸ ਹੋ ਗਏ ਐਰਾ ਵਗੈਰਾ ਤੁਹਾਨੂੰ ਪਤਾ ਅੱਜ ਕੱਲ੍ਹ ਟੈਕਨੋਲਂਜੀ ਬਹੁਤ ਜ਼ਿਆਦਾ ਆ ਅਤੇ ਮੋਬਾਇਲ ਅਤੇ ਗੈਜ਼ਿਟਸ ਵੀ ਬੜੇ ਆ ਵਾਇਰਲੈਸ ਬੈਟਰੀ ਹੋ ਗਏ ਅਤੇ ਨਾਲੇ ਮੈਨੂੰ ਮੋਬਾਇਲ ਠੀਕ ਕਰਨਾ ਡਿਸਪਲੇ ਬਦਲਣੀ ਜਾਂ ਕਿੱਦਾਂ ਐਰਾ ਵਗੈਰਾ ਬਹੁਤ ਨਿੱਕਾ ਮੋਟਾ ਮਤਲਬ ਕੰਮ ਵੀ ਆਉਂਦਾ ਵਾ ਮੋਬਾਈਲਸ ਦਾ ਤਾਂ ਕਰਕੇ ਮੈਂ ਮੋਬਾਇਲ ਦੀ ਸ਼ੋਪ ਖੋਲੂੰਗਾ ਪਰ ਜੇ ਮੋਬਾਇਲ ਦੀ ਸ਼ੋਪ ਦੇ ਨਾਲ ਨਾਲ ਮੈਂ ਕੱਪੜਿਆਂ ਦੀ ਸ਼ੋਪ ਵੀ ਖੋਲ੍ਹਣੀ ਚਾਹੂੰਗਾ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਤੁਹਾਨੂੰ ਪਤਾ ਸੈਲਾਨੀ ਬਹੁਤ ਆਉਂਦੇ ਖਾਸ ਕਰਕੇ ਲੇਡੀਜ਼ ਲੇਡੀਜ਼ ਨੂੰ ਉਹਨਾਂ ਨੂੰ ਪਤਾ ਕੱਪੜਿਆਂ ਦਾ ਬੜਾ ਸ਼ੌਕ ਹੁੰਦਾ ਵਾ ਅਤੇ ਕੱਪੜੇ ਮੈਂ ਵੇਚ ਵੀ ਸਕਦਾ ਵਾਂ ਸੇਲਿੰਗ ਮੈਂ ਪਹਿਲਾਂ ਦੋ ਸਾਲ ਦੁਕਾਨ 'ਤੇ ਵੀ ਕੰਮ ਕੀਤਾ ਹੋਇਆ ਵਾ ਸੇਲ ਕਰਨੀ ਵੀ ਮੈਨੂੰ ਆਉਂਦੀ ਆ ਕਿੱਦਾਂ ਕੱਪੜਿਆਂ ਦੀ ਲੇਡੀਜ਼ ਨਾਲ ਗੱਲਬਾਤ ਕਰਨੀ ਹੋ ਗਈ ਜਾਂ ਕਿੱਦਾਂ ਐਰਾ ਵਗੈਰਾ ਹੋ ਗਿਆ ਲੇਡੀਜ਼ ਨੂੰ ਕਿਹੜਾ ਕੱਪੜਾ ਚਾਹੀਦਾ ਕੱਪੜਿਆਂ ਦੀ ਨੌਲੇਜ ਵੀ ਹੈਗੀ ਆ ਅਤੇ ਆਪਾਂ ਬਹੁਤ ਨਾ ਬਹੁਤ ਪਿਆਰ ਨਾਲ ਮੇਰੇ ਮੰਮਾ ਸੂਟ ਪਾਉਂਦੇ ਆ ਉਹਨਾਂ ਨੂੰ ਮੈਂ ਦ ਦੱਸ ਵੀ ਸਕਦਾ ਵਾਂ ਕਿ ਕਿਹੜਾ ਕੱਪੜਾ ਵਾ ਕਿੱਦਾਂ ਆਪਣੇ ਹੋ ਗਏ ਕੀ ਆਪਣਾ ਸੂਟ ਪਸੰਦ ਹੋ ਗਏ ਕਿੱਦਾਂ